ਹੈਲੋ ਸਤਿ ਸ਼੍ਰੀ ਅਕਾਲ ਅੰਕਲ ਜੀ ਅੰਕਲ ਜੀ ਅਸੀਂ ਤਰਨਤਾਰਨ ਆਉਣਾ ਵਾ ਫੈਮਲੀ ਨੂੰ ਲੈ ਕੇ ਘੁੰਮਣ ਵਾਸਤੇ ਅਤੇ ਇੱਥੇ ਮਤਲਬ ਜਿਹੜਾ ਗੁਰਦੁਆਰਾ ਥੋੜ੍ਹਾ ਸਾਨੂੰ ਇਤਿਹਾਸ ਦੱਸ ਸਕਦੇ ਹੋ ਹਾਂਜੀ

ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਚਲੋ ਠੀਕ ਹੈ ਸਰ ਅਸੀਂ ਫਿਰ ਆ ਰਹੇ ਆ ਰਹੇ ਘੁੰਮਣ ਵਾਸਤੇ ਅਤੇ ਫਿਰ ਅਸੀਂ ਤੁਹਾਨੂੰ ਆ ਕੇ ਫਿਰ ਬੈਕ ਕੋਲ ਕਰਾਂਗੇ ਓਕੇ ਸਰ ਥੈ ਧੰਨਵਾਦ